ਅੱਜ ਕੱਲ੍ਹ ਬਹੁਤ ਨੈਟਵਰਕਾਂ ਦੇ ਸਿੰਮ ਯੂਜ ਕੀਤੇ ਜਾਂਦੇ ਹਨ ਜਿਵੇਂ ਕਿ ਏਅਰਟੈਲ ਆਈਡੀਆ ਬੋਡਾਫੋਨ ਜੀਓ ਜਿਵੇਂ ਕਿ ਮੈਂ ਖੁਦ ਜੀਓ ਯੂਜ ਕਰਦਾ ਹਾਂ ਕੱਲ੍ਹ ਮੈਂ ਬਾਹਰ ਘੁੰਮਣ ਵਾਸਤੇ ਹਿਮਾਚਲ ਵਿਖੇ ਗਿਆ ਜਿੱਥੇ ਕਿ ਜਾ ਕੇ ਮੈਨੂੰ ਰੇਂਜ ਦੀ ਬਹੁਤ ਪ੍ਰੋਬਲਮ ਆਈ ਮੈਂ ਆਪਣੇ ਦੋਸਤ ਨੂੰ ਕਾਲ ਕੀਤੀ ਤਾਂ ਕਾਲ ਨਹੀਂ ਲੱਗੀ ਆਪਣੇ ਘਰ ਕਾਲ ਕੀਤੀ ਕਾਲ ਨਹੀਂ ਲੱਗੀ ਕਸਟਮਰ ਕੇਅਰ 'ਚ ਫੋਨ ਲਗਾ ਦਿੱਤਾ ਉਹਨਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਇਸ ਕਰਕੇ ਮੈਂ ਬਹੁਤ ਇਸ ਕੰਪਨੀ ਤੋਂ ਪਰੇਸ਼ਾਨ ਹਾਂ ਇਸ ਵਿੱਚ ਕੰਪਨੀ ਨੂੰ ਸੁਧਾਰ ਕਰਨ ਦੀ ਲੋੜ ਹੈ